ਪੰਜਾਬ ਵਿੱਚ ਅਭਿਆਸ ਕੀਤੇ ਗਏ ਵੱਖ ਵੱਖ ਧਰਮ ਅੰਤਰ ਸੱਭਿਆਚਾਰਕ ਆਦਾਨ ਪ੍ਰਦਾਨ ਜਾਂ ਸਮਾਜ ਦੇ ਮੁੱਦੇ ਨੂੰ ਹੱਲ ਕਰਨ ਲਈ ਕਾਫ਼ੀ ਤਰੀਕੇ ਵਰਤੇ ਜਾ ਸਕਦੇ ਹਨ ਜਿਵੇਂ ਅੱਜ ਦਾ ਜਵਾਨ ਪੀੜ੍ਹੀ ਅਲੱਗ ਅਲੱਗ ਧਰਮਾਂ ਵਿੱਚ ਵਿਆਹ ਕਰਵਾ ਰਹੀ ਹੈ ਇਹ ਬੁਰਾ ਵੀ ਸਾਬਿਤ ਹੋ ਸਕਦਾ ਹੈ ਅਤੇ ਸਹੀ ਵੀ ਸਾਬਿਤ ਹੋ ਸਕਦਾ ਹੈ ਸਹੀ ਇਸ ਕਰਕੇ ਸਾਬਿਤ ਹੋ ਸਕਦਾ ਹੈ ਜੇਕਰ ਦੋਵੇੇਂ ਵਿਆਹੇ ਵਿੱਚੋਂ ਇੱਕ ਜਾਂ ਮੁੰਡਾ ਕਿਸੇ ਹੋਰ ਧਰਮ ਤੋਂ ਤਾਲੁਕ ਰੱਖਦਾ ਹੈ ਜਾਂ ਕੁੜੀ ਕਿਸੇ ਹੋਰ ਬਿਗਾਨੇ ਧਰਮ ਤੋਂ ਤਾਲੁਕ ਰੱਖਦੀ ਹੈ ਅਤੇ ਉਹਨਾਂ ਦੋਨਾਂ ਦੇ ਮੇਲ ਨਾਲ ਸਿਰਫ਼ ਉਨ੍ਹਾਂ ਦੋਨਾਂ ਦਾ ਮੇਲ ਨਹੀਂ ਹੁੰਦਾ ਦੋ ਧਰਮਾਂ ਦਾ ਮੇਲ ਹੁੰਦਾ ਹੈ ਅਤੇ ਧਰਮਾਂ ਵਿੱਚ ਵੱਧ ਰਹੀ ਜੋ ਕੜਵਾਹਟ ਹੈ ਉਹ ਖ਼ਤਮ ਹੋ ਸਕਦੀ ਹੈ ਇਸ ਕਰਕੇ ਜੇ ਆਪਾਂ ਦੇਖੀਏ ਤਾਂ ਅੰਤਰ ਸੱਭਿਆਚਾਰਕ ਵਿਆਹ ਜਾਂ ਇੰਟਰ ਫੇਥ ਮੈਰਿਜ ਇੱਕ ਹਿਸਾਬ ਨਾਲ ਸਾਡੇ ਸਮਾਜ ਨੂੰ ਵਧੀਆ ਰੁਖ ਵੀ ਦੇ ਰਹੀ ਹੈ ਸੋ ਸਾਨੂੰ ਹਰ ਧਰਮ ਦੀ ਇੱਜਤ ਕਰਨੀ ਚਾਹੀਦੀ ਹੈ ਅਤੇ ਹਰ ਧਰਮ ਦੇ ਤਿਉਹਾਰ ਨੂੰ ਵੱਧ ਚੜ੍ਹ ਕੇ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ ਜੇਕਰ ਅਸੀਂ ਆਪਣੇ ਧ ਧਰਮ ਦੀ ਇੱਜਤ ਚਾਹੁੰਦੇ ਹਾਂ ਤਾਂ ਸਾਨੂੰ ਦੂਸਰਿਆਂ ਦੀ ਧਰਮ ਨੂੰ ਵੀ ਉੱਨੀ ਹੀ ਇੱਜਤ ਦੇਣੀ ਪਵੇਗੀ ਅਤੇ ਸਾਨੂੰ ਧਰਮਾਂ ਦੇ ਨਾਮ ਪਿੱਛੇ ਇਨਸਾਨੀਅਤ ਦਾ ਗਲਾ ਨਹੀਂ ਘੋਟਣਾ ਚਾਹੀਦਾ ਅਤੇ ਧਰਮਾਂ ਦੇ ਨਾਮ 'ਤੇ